ਡਾਂਸ ਨੇ ਮੇਰੀ ਜ਼ਿੰਦਗੀ ਨੂੰ ਉਸਕਾਤਮਕ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਡਾਂਸ ਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ ਡਾਂਸ ਦੇ ਨਾਲ ਅਸੀਂ ਆਪਣੇ ਮਾਨਸਿਕ ਸ਼ਾਂਤੀ ਨੂੰ ਪ੍ਰਾਪਤ ਕਰ ਸਕਦੇ ਹਾਂ ਡਾਂਸ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਕੋਨਫੀਡੈਂਸ ਮਿਲਦਾ ਹੈ ਡਾਂਸ ਕਰਕੇ ਸਾਨੂੰ ਅਸੀਂ ਕਿਸੇ ਦੀ ਖੁਸ਼ੀਆਂ ਨੂੰ ਦੁੱਗਣਾ ਚੋਗਣਾ ਕਰ ਸਕਦੇ ਹਾਂ ਅਤੇ ਡਾਂਸ ਦੇ ਇੱਕ ਕਲਾ ਹੈ ਕਿਸਮ ਕਹਿ ਸਕਦੇ ਐ ਜਿਸਨੂੰ ਜੁੰਬਾ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਇਸ ਨੂੰ ਇਸ ਕਿਸਮ ਦੇ ਡਾਂਸ ਤੋਂ ਅਸੀਂ ਆਪਣੇ ਸਰੀਰ ਦੀ ਐਕਸਰਸਾਈਜ਼ ਕਰ ਸਕਦੇ ਹਾਂ ਇਸਨੂੰ ਕਰਕੇ ਸਾਡੇ ਸਰੀਰ ਦਾ ਭਾਰ ਜੋ ਹੈ ਘੱਟਦਾ ਹੈ ਅਤੇ ਇਸ ਨੂੰ ਕਰਕੇ ਸਾਨੂੰ ਹੋਰ ਕੋਈ ਐਕਸਰਸਾਈਜ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਇਸ ਨਾਲ ਵੀ ਅਸੀਂ ਆਪਣਾ ਜੋ ਹੈ ਭਾਰ ਘਟਾ ਸਕਦੇ ਹਾਂ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਡਾਂਸ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਮੈਂ ਮ ਬਹੁਤ ਜ਼ਿਆਦਾ ਰਿਲੀਫ ਮਹਿਸੂਸ ਕਰਦੀ ਹਾਂ ਡਾਂਸ ਦੇ ਨਾਲ